ਗਾਇਕਾਂ ਦੀਆਂ ਸਭ ਤੋਂ ਆਮ ਗਲਤੀਆਂ ਇਹ ਹਨ ਕਿ ਉਹਨਾਂ ਨੂੰ ਉੱਚੀ ਤਾਲ 'ਤੇ ਹੇਕ ਲਗਾਉਣੀ ਨਹੀਂ ਆਉਂਦੀ ਅੱਜ ਦੇ ਜ਼ਮਾਨੇ ਦੇ ਵਿੱਚ ਸਭ ਕੁਛ ਮਿਊਜ਼ਿਕਾਂ ਨਾਲ ਚੱਲਣ ਲੱਗ ਗਿਆ ਹੈ ਪਹਿਲਾਂ ਜ਼ਮਾਨੇ ਵਿੱਚ ਲੋਕ ਢੋਲਕਾਂ ਛੈਣਕਾਂ ਇਹਨਾਂ ਚੀਜ਼ਾਂ ਰਾਹੀਂ ਗਾਇਕ ਆਪਣੇ ਗਾਣੇ ਗਾ ਕੇ ਲੋਕਾਂ ਦਾ ਮਨੋਰੰਜਨ ਕਰਵਾਉਂਦੇ ਸੀ ਅੱਜ ਕੱਲ੍ਹ ਜ਼ਮਾਨੇ ਵਿੱਚ ਮਿਊਜ਼ਿਕ ਦੇ ਆਉਣ ਨਾਲ ਪੁਰਾਣੇ ਜ਼ਮਾਨੇ ਵਾਲੇ ਗੀਤ ਗਾਇਕਾਂ ਦੇ ਗਾਏ ਹੋਏ ਗੀਤ ਦੀ ਮਹੱਤਤਾ ਅੱਜ ਜ਼ਮਾਨੇ ਵਿੱਚ ਘੱਟ ਚੁੱਕੀ ਹੈ ਪੁਰਾਣੇ ਜ਼ਮਾਨੇ ਵਿੱਚ ਗਾਇਕ ਆਪਣੀ ਸਭ ਤੋਂ ਜ਼ਿਆਦਾ ਪ੍ਰੈਕਟਿਸ ਕਰਕੇ ਆਪਣੇ ਗਾਣੇ ਇੰਨੇ ਜ਼ਿਆਦਾ ਫੇਮਸ ਬਣਾ ਦਿੰਦੇ ਸੀ ਅੱਜ ਕੱਲ੍ਹ ਗਾਇਕਾਂ ਦੇ ਵਿੱਚ ਪਹਿਲਾਂ ਵਾਲੇ ਜ਼ਮਾਨੇ ਜਿੰਨੇ ਰਾਗ ਰੁਚੀਆਂ ਰਹੇ ਨਹੀਂ ਕੁਝ ਗਾਇਕ ਵਾਰਤਾ ਅਜਿਹੇ ਹਨ ਜੋ ਆਪਣੇ ਅਹੰਕਾਰ ਰਾਹੀਂ ਡਿੱਗੇ ਬੈਠੇ ਹਨ ਜਿਵੇਂ ਮੈਂ ਤੁਹਾਨੂੰ ਇੱਕ ਗਾਇਕ ਦਾ ਨਾਮ ਦੱਸ ਰਿਹਾ ਹਾਂ ਸਿੱਧੂ ਮੂਸੇਵਾਲਾ ਉਹ ਇੰਨਾ ਮਸ਼ਹੂਰ ਗਾਇਕ ਹੈ ਉਸ ਦੇ ਗਾਏ ਹੋਏ ਗੀਤ ਅੱਜ ਵੀ ਲੋਕਾਂ ਦਾ ਮਨ ਮੋਹ ਲੈਂਦੇ ਹਨ ਉਸ ਦੇ ਗਾਏ ਹੋਏ ਹਰ ਇੱਕ ਤਾਲ ਅਤੇ ਰਾਗ ਇੰਨਾ ਜ਼ਿਆਦਾ ਵਧੀਆ ਹੈ ਸਿੱਧੂ ਮੂਸੇ ਵਾਲਾ ਸਭ ਦਾ ਦਿਲਚਸਪ ਗਾਇਕਵਾਰ ਹੈ ਅਗਰ ਉਹਨਾਂ ਗਾਇਕਾਂ ਦੀਆਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ ਇਸ ਰਾਹੀ ਆਪਾਂ ਉਹਨਾਂ ਗਲਤੀਆਂ ਤੋਂ ਬਚ ਸਕਦੇ ਹਾਂ ਵੀ ਆਪਾਂ ਜਿਸ ਇਸ ਪੁਰਾਣੇ ਸਮੇਂ ਆਪਾਂ ਰਾਗ ਅਤੇ ਜੋਸ਼ ਨਾਲ ਗਾਣੇ ਗਾਉਂਦੇ ਸੀ ਗਾਇਕ ਆਪਣੇ ਸੁਰ ਨੂੰ ਦਿਖਾਉਂਦੇ ਸੀ ਅੱਜ ਦੇ ਜ਼ਮਾਨੇ ਵਿੱਚ ਗਾਇਕ ਉਹਨਾਂ ਸੁਰਾਂ ਨੂੰ ਭੁੱਲ ਕੇ ਮਿਊਜ਼ਿਕ ਦੀ ਤਾਲ ਉੱਤੇ ਆਪਣੀ ਹੇਕਾਂ ਲਗਾਉਣ ਲੱਗ ਗਏ ਹਨ ਇਹਨਾਂ ਤੋਂ ਬਚਣ ਵਾਸਤੇ ਆਪਾਂ ਨੂੰ ਪੁਰਾਣੇ ਜ਼ਮਾਨੇ ਜਿਵੇਂ ਢੋਲਕ ਛੈਣਕਾਂ ਲੈ ਕੇ ਆਪਣੇ ਸੁਰ ਨੂੰ ਉੱਚਾ ਕਰਕੇ ਲੋਕਾਂ ਦਾ ਮਨ ਮੋਹ ਲੈਣਾ ਚਾਹੀਦਾ ਹੈ